ਹਾਂਜੀ ਫਲਿਪਕਾਰਟ ਤੋਂ ਬੋਲ ਰਹੇ ਹੋ ਜੀ ਹਾਂਜੀ ਸਰ ਮੈਂ ਪਹਿਲਾਂ ਵੀ ਇੱਕ ਪਰਫਿਊਮ ਔਡਰ ਕੀਤਾ ਸੀਗਾ ਡੈਨਵਰ ਕੰਪਨੀ ਦਾ ਜੋ ਬਹੁਤ ਵਧੀਆ ਨਿਕਲਿਆ ਅਤੇ ਉਹਦੀ ਪੈਕਿੰਗ ਵੀ ਬਹੁਤ ਅੱਛੀ ਸੀ ਅਤੇ ਸੀਲ ਬੰਦ ਸੀਗੇ ਪਰ ਜਿਹੜਾ ਮੈਂ ਉਹ ਤੋਂ ਦੁਬਾਰਾ ਉਹਨੂੰ ਦੇਖਦੇ ਹੋਏ ਇੱਕ ਹੋਰ ਔਡਰ ਕੀਤਾ ਪਰਫਿਊਮ ਪਰ ਜਿਹੜੀ ਉਹਦੀ ਪੈਕਿੰਗ ਸੀਗੀ ਉਹ ਬਿਲਕੁਲ ਲੂਜ ਸੀਗੀ ਅਤੇ ਨਾਲ ਹੀ ਉਹਦਾ ਜਿਹੜਾ ਢੱਕਣ ਉਹ ਵੀ ਤਿੰਨੋਂ ਦੇ ਤਿੰਨੋਂ ਲੂਜ ਸੀਗੇ ਕੋਂਬੋ ਪੈਕ ਸੀਗਾ ਹਾਂਜੀ ਦੀਪਕ ਲੜਕਾ ਸੀਗਾ ਜੋ ਮੈਨੂੰ ਦੇਣ ਆਇਆ ਸੀਗਾ ਅਤੇ ਉਹ ਜਲਦੀ ਦੇ ਵਿੱਚ ਸੀਗਾ ਮੈਨੂੰ ਇੱਦਾਂ ਹੀ ਹੈਂਡਓਵਰ ਕਰਕੇ ਉਹ ਚਲਾ ਗਿਆ ਅਤੇ ਮੈਂ ਪਹਿਲਾਂ ਵੀ ਬਹੁਤ ਚੀਜ਼ਾਂ ਫਲਿਪਕਾਰਟ ਤੋਂ ਮੰਗਵਾਈਆਂ ਜੋ ਕਿ ਜਿਹ ਤੋਂ ਮੈਂ ਸੈਟਿਸਫਾਈਡ ਹਾਂ ਪਰ ਇਸ ਵਾਰ ਮੈਂ ਬਹੁਤ ਹੀ ਜਿਹਨੂੰ ਕਹਿੰਦੇ ਉਹ ਦੁੱਖਦਾਈ ਹੋਇਆ ਇਸ ਚੀਜ਼ ਨੂੰ ਲੈ ਕੇ ਅਤੇ ਕਿਰਪਾ ਕਰਕੇ ਜਿਹੜੀ ਇਹ ਚੀਜ਼ ਦੁਬਾਰਾ ਤੋਂ ਨਾ ਹੋਵੇ ਅਤੇ ਨਾ ਹੀ ਕਿਸੇ ਹੋਰ ਕਸਟਮਰ ਨਾਲ ਹੋਵੇ

ਅਤੇ ਦੁਬਾਰਾ ਇਹਨੂੰ ਚੇਂਜ ਕੀਤਾ ਜਾਵੇ ਤਾਂ ਕਿ ਜੋ ਮੈਨੂੰ ਨਵੇਂ ਪਰਫਿਊਮ ਮਿਲ ਸਕਣ ਅਤੇ ਉਹ ਬਿਲਕੁਲ ਹੀ ਪੈਕਿੰਗ ਉਹਨਾਂ ਦੀ ਪ੍ਰੋਪਰ ਹੋਵੇ